ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀ ਜਿਹੜੀ ਕੰਪਨੀਆਂ ਨੇ ਉਹ ਬਹੁਤ ਸਾਰੀਆਂ ਬਾਈਕ ਜਿਹੜੀਆਂ ਨੇ ਬਣਾ ਰਹੀਆਂ ਨੇ ਅਤੇ ਬਹੁਤ ਹੀ ਵਧੀਆ ਨੇ ਅਤੇ ਮੈਨੂੰ ਜਿਹੜੀ ਬਾਈਕ ਪਸੰਦ ਹੈ ਉਹ ਆਰ ਫਿਫਟੀਨ ਹੈ ਕਿਉਂਕਿ ਜਿਹੜੀ ਇਹ ਬਾਈਕ ਹੈਗੀ ਹੈ ਇਹ ਬਹੁਤ ਹੀ ਜ਼ਿਆਦਾ ਸਮੂਥ ਚੱਲਦੀ ਹੈ ਬਹੁਤ ਹੀ ਵਧੀਆ ਇਹਦੀ ਮਾਈਲੇਜ ਹੈਗੀ ਹੈ ਅਤੇ ਮੈਨੂੰ ਇਹਦੀ ਲੁੱਕ ਵੀ ਬਹੁਤ ਜ਼ਿਆਦਾ ਪਸੰਦ ਹੈ